ਵਿਲੱਖਣ ਪਕਵਾਨ ਕਾਫੀ ਸਾਰੇ ਹਨ ਜਿਹੜੇ ਕਿ ਅਸੀਂ ਤਿਆਰ ਕਰਦੇ ਹਾਂ ਖਾਸ ਕਰਕੇ ਅਗਰ ਅਸੀਂ ਅਚਾਰਾਂ ਦੀ ਗੱਲ ਕਰੀਏ ਤਾਂ ਜਿਵੇਂ ਕਿ ਗੋਭੀ ਗਾਜਰਾਂ ਦਾ ਆਚਾਰ ਹੋ ਗਿਆ ਨਿੰਬੂ ਦਾ ਅਚਾਰ ਫਿਰ ਹੋ ਗਿਆ ਗਲਗਲ ਦਾ ਆਚਾਰ ਸੋ ਜਿਹੜੇ ਇਹ ਅਚਾਰ ਹਨ ਇਹ ਬੜੇ ਵੱਖਰੇ ਤਰੀਕੇ ਨਾਲ ਤਿਆਰ ਹੁੰਦੇ ਹਨ ਜਿਵੇਂ ਕਿ ਅਗਰ ਅਸੀਂ ਨਿੰਬੂ ਦਾ ਅਚਾਰ ਲੈ ਲਈਏ ਤਾਂ ਉਹਦੇ ਵਿੱਚ ਨਿੰਬੂ ਦੀ ਮ੍ਰ ਮੰਨ ਲਓ ਇੱਕ ਕਿਲੋ ਨਿੰਬੂ ਹਨ ਤਾਂ ਤੁਸੀਂ ਉਹਦਾ ਢਾਈ ਸੌ ਗ੍ਰਾਮ ਜਿਹੜਾ ਨਮਕ ਹੈ ਉਹ ਉਹਦੇ ਵਿੱਚ ਪਾਉਣਾ ਹੈ ਉਹਦੇ ਨਾਲ ਫਿਰ ਤੁਹਾਡੇ ਹਲਕੀ ਜਿਹੀ ਹਲਦੀ ਜੀ ਤੁਹਾਡੇ ਲੋੜ ਮੁਤਾਬਿਕ ਫਿਰ ਵਿੱਚ ਹਰੀਆਂ ਅਤੇ ਲਾਲ ਕਸ਼ਟ ਮਿਰਚਾਂ ਵੀ ਤੁਸੀਂ ਵਰਤ ਸਕਦੇ ਹਾਂ ਲਾਲ ਮਿਰਚ ਵੀ ਵਰਤ ਸਕਦੇ ਹਾਂ ਇਸ ਤੋਂ ਇਲਾਵਾ ਜੀਰਾ ਜਿਹੜਾ ਹੈਗਾ ਆ ਅਤੇ ਜਵੈਣ ਇਸਦਾ ਜਿਹੜਾ ਤੜਕਾ ਹੈ ਉਹ ਨਿੰਬੂ ਦੇ ਅਚਾਰ ਨੂੰ ਚਾਰ ਚੰਨ ਲਾਉਂਦਾ ਹੈ ਸਭ ਤੋਂ ਪਹਿਲਾਂ ਤੁਸੀਂ ਨਿੰਬੂ ਨੂੰ ਕੱਟ ਲਓ ਕੱਟ ਕੇ ਫਿਰ ਤੁਸੀਂ ਕੜਾਹੀ ਦੇ ਵਿੱਚ ਜੀਰੇ ਨੂੰ ਭੁੰਨ ਲਓ ਤੇਲ ਪਾਓ ਤੇਲ ਪਾ ਕੇ ਜੀਰੇ ਨੂੰ ਭੁੰਨ ਲਓ ਫਿਰ ਥੋੜ੍ਹੀ ਜਵੈਣ ਪਾ ਦਿਓ ਜਵੈਣ ਦੀ ਮਾਤਰਾ ਬਹੁਤ ਜ਼ਿਆਦਾ ਨਹੀਂ ਕਰਨੀ ਚਾਹੀਦੀ ਉਹਦੇ ਨਾਲੇ ਕੜਵਾਪਨ ਆਉਂਦਾ ਹੈ ਫਿਰ ਤੁਸੀਂ ਲੂਣ ਮਸਾਲੇ ਜਿਹੜੇ ਹੈਗੇ ਆ ਉਹ ਪਾ ਕੇ ਫਿਰ ਤੁਸੀਂ ਇਹਦੇ ਵਿੱਚ ਲਸਣ ਦਾ ਜਿਹੜੀ ਵਰਤੋਂ ਹੈ ਉਹ ਜ਼ਰੂਰ ਕਰੋ ਉਹ ਲਸਣ ਦੇ ਨਾਲ ਇਸ ਵਿੱਚੋਂ ਖੁਸ਼ਬੂ ਬਹੁਤ ਜ਼ਿਆਦਾ ਵਧੀਆ ਆਉਂਦੀ ਹੈ ਅਤੇ ਇਸ ਤੋਂ ਬਾਅਦ ਜਦੋਂ ਬਿਲਕੁਲ ਅਚਾਰ ਬਣ ਜਾਵੇ ਤਾਂ ਬਾਅਦ ਵਿੱਚੋਂ ਗੈਸ ਬੰਦ ਕਰਨ ਤੋਂ ਬਾਅਦ ਥੋੜ੍ਹੀ ਜਿਹੀ ਚੀਨੀ ਜਿਹੜੀ ਆ ਉਹਦੇ ਵਿੱਚ ਮਿਕਸ ਕਰ ਦੇਣੀ ਚਾਹੀਦੀ ਤਾਂ ਕਿ ਜਿਹੜੀ ਨਿੰਬੂ ਦੀ ਖਟਾਸ ਹੈ ਉਹ ਘੱਟ ਜਾਵੇ ਇਸੇ ਤਰ੍ਹਾਂ ਅਗਰ ਅਸੀਂ ਗਲਗਲ ਦੇ ਅਚਾਰ ਦੀ ਗੱਲ ਕਰੀਏ ਤਾਂ ਇਹ ਨਿੰਬੂ ਦੇ ਨਾਲ ਮਿਲਦੇ ਹੀ ਸਾਰੇ ਮਸਾਲੇ ਹਨ ਪਰ ਇਹਦੇ ਵਿੱਚ ਮੇਥਿਆਂ ਦੀ ਵਰਤੋਂ ਹੁੰਦੀ ਹੈ ਜਿਵੇਂ ਕਿ ਜੀਰੇ ਦੀ ਮੇਥੇ ਦੀ ਤੁਸੀਂ ਭੁੰਨ ਲਓ ਭੁੰਨ ਕੇ ਗਲਗਲ ਦਾ ਜ ਇਹਦੇ ਵਿੱਚ ਨਮਕ ਜਿਹੜਾ ਹੈ ਮੰਨ ਲਓ ਉਹੀ ਮਾਤਰਾ ਰਹਿਣੀ ਹੈ ਅਗਰ ਕਿੱਲੋ ਅਚਾਰ ਹੈ ਤਾਂ ਉਹਦੇ ਵਿੱਚ ਢਾਈ ਸੌ ਗ੍ਰਾਮ ਤੁਸੀਂ ਨਮਕ ਪਾਓ ਨਮਕ ਪਾ ਕੇ ਹਲਦੀ ਪਾ ਦੋ ਮਿਰਚ ਪਾ ਦੋ ਅਤੇ ਮਿਰਚ ਪਾ ਕੇ ਇਸਨੂੰ ਚੰਗੀ ਤਰ੍ਹਾਂ ਹਿਲਾ ਕੇ ਇਸ ਨੂੰ ਐਨ ਤਿਆਰ ਕਰ ਲਓ ਉਸ ਤੋਂ ਬਾਅਦ ਅਗਰ ਜਾਇਜ਼ ਸਮਝੋ ਤਾ ਹਲਕੀ ਜਿਹੀ ਚੀਨੀ ਜਿਹੜੀ ਹੈ ਉਹ ਬੰਦ ਕਰਨ ਤੋਂ ਬਾਅਦ ਇਹਦੇ ਵਿੱਚ ਘੱਟ ਚੀਨੀ ਪੈਂਦੀ ਹੈ ਅਤੇ ਨਿੰਬੂ ਦੇ ਅਚਾਰ ਵਿੱਚ ਥੋੜ੍ਹੀ ਜਿਹੀ ਚੀਨੀ ਜ਼ਿਆਦਾ ਪੈਂਦੀ ਹੈ ਸੋ ਇਸ ਤਰ੍ਹਾਂ ਜਿਹੜੇ ਇਹ ਵਿਲੱਖਣ ਪਕਵਾਨ ਹਨ ਜਿਹੜੇ ਹਨ ਇਹ ਤਿਆਰ ਹੁੰਦੇ ਹਨ